ਹਾਂਜੀ ਜਿਹੜਾ ਓਇਲ ਪੇਂਟਿੰਗ ਹੁੰਦਾ ਨਾ ਇਹਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਪ੍ਰਾਈਮਰ ਹੈਗੇ ਜਿਹੜੇ ਉਹ ਮਿਲਾ ਸਕਦੇ ਹਾਂ ਜਿਹੜੇ ਇਹ ਪ੍ਰਾਈਮਰ ਆ ਨਾ ਕੈਨਵਸ ਨੂੰ ਤਿਆਰ ਕਰਨਾ ਅਤੇ ਪੇਂਟ ਨੂੰ ਚੰਗੀ ਤਰ੍ਹਾਂ ਲੱਗਣ ਦੇ ਲਈ ਵੀ ਉਹਦੇ 'ਤੇ ਚੰਗੀ ਤਰ੍ਹਾਂ ਪੇਂਟ ਹੋ ਜਾਵੇ ਉਹਦੇ ਲਈ ਵਰਤੇ ਜਾਂਦੇ ਨੇ ਅਤੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਵੱਧਦਾ ਨਾ ਮੈਂ ਉਹ ਓਇਲ ਜੋਇਸ ਇਹ ਜਿਹੜਾ ਪ੍ਰਾਈਮਰ ਤੇਲ ਨੂੰ ਮੈਂ ਪੇਂਟ ਕਰਨ ਲਈ ਖ਼ਾਸ ਤੌਰ 'ਤੇ ਜਿਹੜਾ ਤਿਆਰ ਕੀਤਾ ਜਾਂਦਾ ਇਸ ਨੂੰ ਮੈਂ ਵਰਤਦਾ ਹੈਗਾ ਕਿਉਂਕਿ ਇਹਦੇ ਨਾਲ ਨਾ ਕੈਨਵਸ ਨੂੰ ਇੱਕ ਤੇਲੀ ਸਤ੍ਹਾ ਦਿੰਦੇ ਹਨ ਸੋ ਤੇਲ ਪੇਂਟ ਨੂੰ ਚੰਗੀ ਤਰ੍ਹਾਂ ਆਪਣੇ ਨਾਲ ਸੋਖ ਲੈਂਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਮੈਂ ਆਪਣੇ ਪੇਂਟਿੰਗ ਵਾਲੇ ਰੰਗਾਂ ਦੀ ਟੋਨ ਕਿਵੇਂ ਬਣ ਬਣੋ ਮਿਲਾਉਂਦਾ ਹੈਗਾ ਉਹਦੇ ਨਾਲ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਜਿਹੜਾ ਓਇਲ ਪੇਂਟਿੰਗ ਦੇ ਵਿੱਚ ਰੰਗ ਮਿਲਾਉਣਾ ਨਾ ਇੱਕ ਬਹੁਤ ਹੀ ਮਹੱਤਵਪੂਰਨ ਹੁਨਰ ਹੈ ਇਹ ਸਾਰਿਆਂ ਨੂੰ ਨਹੀਂ ਆਉਂਦਾ ਹੁੰਦਾ ਇਹ ਨਾ ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ ਪ੍ਰੈਕਟਿਸ ਕਰਨ ਦੇ ਨਾਲ ਨਾਲ ਆਪਾਂ ਨੂੰ ਆਈ ਜਾਂਦਾ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ 'ਚ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਵੀ ਥੋੜ੍ਹਾ ਥੋੜ੍ਹਾ ਕਰਕੇ ਰੰਗ ਬਣਾਉਣਾ ਚਾਹੀਦਾ ਇੱਕੇ ਲਖਤ ਸਾਨੂੰ ਇਹ ਨਹੀਂ ਗਾ ਵੀ ਵਾਹ ਵਾਹ ਰੰਗ ਇੱਕੇ ਲਖਤ ਹੀ ਅਸੀਂ ਪਲੇਟ 'ਚ ਪਾ ਲਈਏ ਨਹੀਂ ਸਗੋਂ ਉਹਨੂੰ ਥੋੜ੍ਹਾ ਥੋੜ੍ਹਾ ਕਰਕੇ ਉਹਦਾ ਐਕਸਪੈਰੀਮੈਂਟ ਕਰਨਾ ਚਾਹੀਦਾ ਵੀ ਦੇਖ ਵੀ ਉਹ ਬਣ ਗਿਆ ਜਿਹਨੂੰ ਮੈਨੂੰ ਚਾਹੀਦਾ ਕਿੰਨਾ ਹੋਰ ਪਾਵਾਂ ਇਹ ਠੀਕ ਹੈ ਜੀ ਫਿਰ ਇੱਕ ਰੰਗ ਨੂੰ ਦੂਜੇ ਰੰਗ ਦੇ ਵਿੱਚ ਮਿਲਾਉਣਾ ਹੈ ਨਾ ਇੱਕ ਰੰਗ ਨੂੰ ਦੂਜੇ ਰੰਗ ਵਿੱਚ ਮਿਲਾਉਣ ਦੇ ਨਾਲ ਇੱਕ ਨਾ ਨਵਾਂ ਰੰਗ ਬਣਦਾ ਹੈਗਾ ਠੀਕ ਆ ਅਤੇ ਇੱਕ ਆਪਾਂ ਇਹ 'ਚ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਜਿਹੜਾ ਕਾਲਾ ਰੰਗ ਹੈ ਉਹਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਆਪਣੀ ਕਿਉਂ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਕਾਲਾ ਰੰਗ ਹੈਗਾ ਇਹ ਦੂਜੇ ਰੰਗਾਂ ਨੂੰ ਗੰਦਾ ਕਰ ਦਿੰਦਾ ਹੈਗਾ ਅਤੇ ਇਹਨੂੰ ਕੀ ਆ ਹਮੇਸ਼ਾ ਘੱਟ ਵਰਤੋ ਅਤੇ ਜਿਹੜਾ ਸਫੇਦ ਰੰਗ ਹੈਗਾ ਇਹਨੂੰ ਵੱਧ ਵਰਤੋ ਕਿਉਂ ਵਰਤੋ ਕਿਉਂਕਿ ਕਿਸੇ ਵੀ ਰੰਗ ਨੂੰ ਹਲਕਾ ਕਰਨ ਦੇ ਲਈ ਵਰਤਿਆ ਜਾਂਦਾ ਹੈਗਾ ਅਤੇ ਇੱਕ ਪਲੇਟ ਦੇ ਵਿੱਚ ਰੰਗ ਮਿਲਾਉਣੇ ਚਾਹੀਦੇ ਆ ਆਪਾਂ ਨੂੰ ਆਪਾਂ ਨੂੰ ਹੋਰ ਨਹੀਂ ਠੀਕ ਐ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਨਾਲ ਰੰਗ ਮਿਲਾਉਣੇ ਚਾਹੀਦੇ ਆ ਅਤੇ ਇਹਦਾ ਅਭਿਆਸ ਕਰਨਾ ਚਾਹੀਦਾ ਹੈਗਾ ਅਤੇ ਅਸੀਂ ਛੇਤੀ ਹੀ ਇਹਦੇ ਵਿੱਚ ਇੱਕ ਮੁਹਾਰਤ ਹਾਸਲ ਕਰ ਲਵਾਂਗੇ ਤਾਂ ਮੇਰਾ ਇਹ ਹੀ ਐਕਸਪੀਰੀਅਂਸ ਸੀ ਜੋ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਿਆ ਜੀ ਧੰਨਵਾਦ ਜੀ